ਜੇਕਰ ਬਜ਼ੁਰਗ ਲੋਕਾਂ ਦੀਆਂ ਖੇਡਾਂ ਦੀ ਗੱਲ ਕਰੀਏ ਤਾਂ ਬਜ਼ੁਰਗ ਲੋਕ ਕੁਸ਼ਤੀ ਅਤੇ ਕਬੱਡੀ ਵਰਗੀਆਂ ਖੇਡਾਂ ਬਹੁਤ ਜ਼ਿਆਦਾ ਖੇਡਦੇ ਰਹੇ ਹਨ ਅਤੇ ਅੱਜ ਕੱਲ੍ਹ ਵੀ ਉਹ ਇਹਨਾਂ ਖੇਡਾਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੇ ਹਨ ਸੋ ਬਜ਼ੁਰਗ ਲੋਕਾਂ ਦੀਆਂ ਜੋ ਵੀ ਖੇਡਾਂ ਹਨ ਉਹ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਘੱਟਦੀਆਂ ਜਾ ਰਹੀਆਂ ਹਨ ਪਰ ਬਜ਼ੁਰਗ ਰੋਕ ਲੋਕ ਇਹਨਾਂ ਖੇਡਾਂ ਨਾਲ਼ ਜੁੜੇ ਹੋਏ ਹਨ ਅਤੇ ਉਹ ਅੱਜ ਵੀ ਇਹਨਾਂ ਖੇਡਾਂ ਨਾਲ਼ ਹੀ ਖੇਡਾਂ ਨੂੰ ਹੀ ਪਸੰਦ ਕਰਦੇ ਹਨ